ਤੇਈ ਦੋ ਸੌ ਉਣਾਹਠ ਛੇ ਹਜ਼ਾਰ ਸੱਤ ਸੌ ਉਣਾਸੀ ਅੱਸੀ ਹਜ਼ਾਰ ਨੌਂ ਸੌ ਸਤੱਤਰ ਨੌਂ ਲੱਖ ਅਠੱਤਰ ਹਜ਼ਾਰ ਚਾਰ ਸੌ ਚੁਤਾਲੀ